ਸਾਡੇ ਇੱਥੇ ਬਹੁਤ ਤਰ੍ਹਾਂ ਦੇ ਪੰਛੀ ਦਿਖਾਈ ਦਿੰਦੇ ਹਨ ਜਿਵੇਂ ਕਬੂਤਰ ਚਿੜੀ ਕਾਂ ਬਾਜ ਬਹੁਤ ਤਰ੍ਹਾਂ ਦੇ ਪੰਛੀ ਦਿਖਾਈ ਦਿੰਦੇ ਹਨ ਇਹ ਤਰ੍ਹਾਂ ਤਰ੍ਹਾਂ ਦੇ ਪੰਛੀ ਇੱਥੇ ਕਈ ਤਰ੍ਹਾਂ ਦੇ ਪੰਛੀ ਹੁੰਦੇ ਹਨ ਜਿਵੇਂ ਮੋਰ ਠੀਕ ਆ ਇੱਥੇ ਸਾਡੀ ਕੋਈ ਫੀਸ ਨਹੀਂ ਹੁੰਦੀ ਹੈ ਇੱਥੇ ਜਿਵੇਂ ਕਿ ਜੂਅ ਹੁੰਦੀ ਹੈ ਇੱਥੇ ਫੀਸ ਨਹੀਂ ਹੁੰਦੀ ਮਤਲਬ ਜ਼ਿਆਦਾ ਤੋਂ ਜ਼ਿਆਦਾ ਪੰਜਾਹ ਰੁਪਏ ਹੁੰਦੀ ਹੈ ਇਸ ਤੋਂ ਵੱਧ ਨਹੀਂ ਹੁੰਦੀ ਹੈ ਇੱਥੇ ਕਈ ਤਰ੍ਹਾਂ ਦੇ ਜਿਵੇਂ ਪੰਛੀ ਹੁੰਦੇ ਹਨ ਜਿਵੇਂ ਕਿ ਕਾਂ ਕਬੂਤਰ ਚਿੜੀ ਬਾਜ ਬਹੁਤ ਤਰ੍ਹਾਂ ਦੇ ਪੰਛੀ ਹੁੰਦੇ ਹਨ ਇੱਥੇ ਕਈ ਤਰ੍ਹਾਂ ਕਿੰਨੇ ਕ ਕਈ ਕਈ ਥਾਵਾਂ 'ਤੇ ਜੂਅ ਹੁੰਦੇ ਹਨ ਜਿੱਥੇ ਕਈ ਤਰ੍ਹਾਂ ਦੇ ਪੰਛੀ ਹੁੰਦੇ ਹਨ ਲੋਕ ਦੇਖਣ ਨੂੰ ਜਾਂਦੇ ਹਨ ਉੱਥੇ ਪੰਜਾਹ ਰੁਪਏ ਦੀ ਫੀਸ ਹੁੰਦੀ ਹੈ ਇਸ ਤਰ੍ਹਾਂ ਲੋਕ ਅਪ